ਸਰਕਾਰੀ ਐਪ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਐਜੂਕੇਟ ਜਿਹੜਾ ਕੀ ਬੱਚਿਆਂ ਦੇ ਵਿਦਿਆਰਥੀਆਂ ਜਿਹੜੇ ਕੀ ਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਐਪ ਹੈ ਉਨ੍ਹਾਂਂ ਦੀ ਪੜ੍ਹਾਈ ਵਿੱਚ ਇਹ ਬਹੁਤ ਜ਼ਿਆਦੇ ਸਹਾਇਤਾ ਕਰਦਾ ਹੈ ਜੇਕਰ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਿਹਾ ਅਤੇ ਉਸ ਐਪ ਵਿੱਚ ਆਪਣੇ ਅਲੱਗ ਅਲੱਗ ਸਬਜੈਕਟਾਂ ਰਾਹੀਂ ਜੋ ਵੀ ਹੈ ਉਹਨਾਂ ਕੋਲ਼ ਉਹ ਦੇਖ ਸਕਦੇ ਨੇ ਅਤੇ ਆਪਣੇ ਕੰਮ ਨੂੰ ਅੱਗੇ ਕਰ ਸਕਦੇ ਹਨ